ਜਦੋਂ ਸਾਡੇ ਕੋਈ ਕੀੜਾ ਮਕੌੜਾ ਲੜਦਾ ਹੈ ਜਿੱਦਾਂ ਕੋਈ ਤਮੂੜੀ ਵਗੈਰਾ ਲੜਦੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਉਹਦਾ ਡੰਗ ਕੱਢਣਾ ਚਾਹੀਦਾ ਫਿਰ ਉਸ ਤੋਂ ਬਾਅਦ ਵਿੱਚ ਸਾਨੂੰ ਉਹਨੂੰ ਕਿਸੇ ਸਾਫ ਕੱਪੜੇ ਦੇ ਨਾਲ ਉਹਨੂੰ ਸਾਫ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਵਿੱਚ ਸਾਨੂੰ ਕਿਸੇ ਕੱਪੜੇ ਦੇ ਵਿੱਚ ਆਈਸ ਪਾ ਕੇ ਅਤੇ ਉਹਨੂੰ ਆਈਸ ਨਾਲ ਉੱਤੇ ਰੱਬ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਉਹਦੇ ਨਾਲ ਸਾਨੂੰ ਇਹ ਹੈ ਕਿ ਥੋੜ੍ਹੀ ਬਹੁਤੀ ਸਾਨੂੰ ਰਾਹਤ ਮਿਲ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਵਿੱਚ ਸਾਨੂੰ ਨਿੰਮ ਦੇ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਨੂੰ ਘੋਟ ਕੇ ਉਹਨਾਂ ਦਾ ਜਿਹੜਾ ਪੇਸਟ ਹੈ ਉਹ ਲਗਾਉਣਾ ਚਾਹੀਦਾ ਵਾ ਉਹਦੇ ਨਾਲ ਇਹ ਹੈ ਕੀ ਸਾਨੂੰ ਰਾਹਤ ਮਿਲ ਜਾਂਦੀ ਆ ਉਹ ਜਿਹੜਾ ਸਾਡੇ ਤਮੂੜੀ ਲੜੀ ਹੁੰਦੀ ਹੈ ਉਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਰਾਹਤ ਮਿਲ ਜਾਂਦੀ ਆ ਜਿਹਦੇ ਨਾਲ ਸਾਡਾ ਜਿਹੜਾ ਦਰਦ ਹੁੰਦਾ ਵਾ ਉਹ ਕਾਫੀ ਹੱਦ ਤੱਕ ਘੱਟ ਜਾਂਦਾ ਵਾ ਕਿਉਂਕਿ ਜਦੋਂ ਆਪਾਂ ਕਿਸੇ ਤੋਂ ਬਾਹਰੋਂ ਦਵਾਈ ਲੈਂਦੇ ਹਾਂ ਉਹਦੇ ਨਾਲ ਸਾਨੂੰ ਇੰਨੀ ਜਲਦੀ ਫਰਕ ਨਹੀਂ ਪੈਂਦਾ ਹੈਗਾ ਜਿੰਨਾ ਕਿ ਸਾਨੂੰ ਘਰੇਲੂ ਇਲਾਜ ਦੇ ਨਾਲ ਫਰਕ ਪੈਂਦਾ ਹੁੰਦਾ ਜਦੋਂ ਸਾਡੇ ਕੋਈ ਹੋਰ ਕੋਈ ਕੀੜਾ ਮਕੌੜਾ ਵੀ ਲੜ ਜੇ ਅਤੇ ਤਾਂ ਵੀ ਸਾਨੂੰ ਕੋਈ ਘਰੇਲੂ ਇਲਾਜ ਹੀ ਕਰਨਾ ਚਾਹੀਦਾ ਜਦੋਂ ਮੱਛਰ ਵਗੈਰਾ ਕੁਝ ਲੜਦਾ ਅਤੇ ਸਾਨੂੰ ਉਸੇ ਟਾਈਮ ਦੇ ਉੱਤੇ ਉਹਦੇ ਉੱਤੇ ਕੁਛ ਓਇਲ ਵਗੈਰਾ ਲਗਾ ਲੈਣਾ ਚਾਹੀਦਾ ਜਿਹਦੇ ਨਾਲ ਕਿ ਇੰਨੀ ਜ਼ਿਆਦਾ ਪੇਨ ਨਹੀਂ ਹੁੰਦੀ ਹੈਗੀ ਅਤੇ ਕਾਫੀ ਤੋਂ ਜ਼ਿਆਦਾ ਸਾਨੂੰ ਰਾਹਤ ਮਿਲ ਜਾਂਦੀ ਹੈ ਜਦੋਂ ਆਪਾਂ ਮੈਡੀਸਨ ਦਵਾਂਗੇ ਉਹਦੇ ਨਾਲ ਸਾਨੂੰ ਇੰਨਾਂ ਜ਼ਿਆਦਾ ਉਹਦਾ ਬੈਨੀਫਿਟ ਨਹੀਂ ਹੁੰਦਾ ਹੈਗਾ ਜਿੰਨਾ ਕਿ ਸਾਨੂੰ ਘਰੇਲੂ ਇਲਾਜ ਦੇ ਨਾਲ ਬੈਨੀਫਿਟ ਹੁੰਦਾ ਵਾ ਜਦੋਂ ਕੋਈ ਸਾਡੇ ਉਹ ਕੀੜਾ ਵਾ ਕੀੜੀ ਵੀ ਲੜ ਜੇ ਤਾਂ ਸਾਨੂੰ ਉਸ ਜਗ੍ਹਾ ਦੇ ਉੱਪਰ ਓਇਲ ਲਗਾ ਲੈਣਾ ਚਾਹੀਦਾ ਹਲਦੀ ਲਗਾ ਲੈਣੀ ਚਾਹੀਦੀ ਹੈ ਬਰਫ ਮਲਣੀ ਚਾਹੀਦੀ ਹੈ ਜਿਹਦੇ ਨਾਲ ਕਿ ਸਾਨੂੰ ਕਾਫੀ ਜ਼ਿਆਦਾ ਰਾਹਤ ਮਿਲ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਸਾਨੂੰ ਉਹਦੀ ਰਾਹਤ ਮਿਲਦੀ ਅਗਰ ਆਪਾਂ ਬਾਹਰੋਂ ਮੈਡੀਸਨ ਲੈਂਦੇ ਤਾਂ ਸਾਨੂੰ ਇੰਨੀ ਜ਼ਿਆਦਾ ਰਾਹਤ ਨਹੀਂ ਮਿਲਦੀ ਜਿੰਨੀ ਸਾਨੂੰ ਘਰੇਲੂ ਇਲਾਜ ਦੇ ਨਾਲ ਰਾਹਤ ਮਿਲਦੀ ਆ ਅਤੇ ਇਸ ਕਰਕੇ ਸਾਨੂੰ ਘਰੇਲੂ ਇਲਾਜ ਹੀ ਲੈਣੇ ਚਾਹੀਦੇ ਹਨ